ਮੈਂ ਬੋਲਦਾ ਪਿਆ ਮੈਂ ਨਾ ਅੰਮ੍ਰਿਤਸਰ ਆਇਆ ਸੀ ਅੰਮ੍ਰਿਤਸਰ ਘੁੰਮਣ ਬਾਹਰੋਂ ਆਇਆ ਹਾਂ ਟੂਰਿਸਟ ਅਤੇ ਹੁਣ ਅਤੇ ਹੁਣ ਮੈਂ ਨਾ ਅੰਮ੍ਰਿਤਸਰ 'ਚ ਘੁੰਮ ਲਿਆ ਹੁਣ ਹੋਰ ਕਿਤੇ ਬਾਹਰ ਘੁੰਮਣਾ ਹੋਵੇ ਤਾਂ ਮੈਂ ਕਿੱਥੇ ਜਾਵਾਂ ਕੋਈ ਹਿਲ ਸਟੇਸ਼ਨ ਕਿਹੜੇ ਹੈਗੇ ਆ ਲਾਗੇ ਅੱਛਾ ਅੱਛਾ ਅੱਛਾ ਜੀ

ਅਤੇ ਹੁਣ ਨਾ ਜਾਈਏ ਫਿਰ ਅੱਛਾ ਅੱਛਾ ਅੱਛਾ ਅੱਛਾ ਠੀਕ ਆ ਠੀਕ ਠੀਕ ਅੱਛਾ ਅੱਛਾ ਅੱਛਾ ਠੀਕ ਹੈ ਜੀ ਹੋਰ ਕਿਤੇ ਲੋੜ ਹੋਈ ਫਿਰ ਮੈਂ ਤੁਹਾਨੂੰ ਫ਼ੋਨ ਕਰਕੇ ਪੁੱਛ ਲਉਂਗਾ ਠੀਕ ਆ ਜੀ